ਸਮਕਾਲੀ ਪੰਜਾਬੀ ਸਿਹਤ ਸਿਧਾਂਤ ਸਮਾਂ ਸਮਾਂ ਕਾਲ ਵਿੱਚ ਰਚੇ ਜਾ ਰਹੇ ਸਾਹਿਤ ਨੂੰ ਸਮਕਾਲੀ ਪੰਜਾਬੀ ਸਿਹਤ ਕਿਹਾ ਜਾਂਦਾ ਹੈ ਸਮਕਾਲ ਨੂੰ ਇੱਕ ਵਿਲੱਖਣ ਯੁਗ ਦੀ ਤੌਰ 'ਤੇ ਸਥਾਪਿਤ ਕਰਦਿਆਂ ਡਾਕਟਰ ਤੇਜਵੰਤ ਸਿੰਘ ਗਿੱਲ ਨੇ ਕਿਹਾ ਕਿ ਸਮਕਾਲ ਨੂੰ ਵੀਹਵੀਂ ਸਦੀ ਦੇ ਅੰਤਲੇ ਤਿੰਨ ਸਾਲਾਂ ਤੋਂ ਆਪਣੀ ਪਛਾਣ ਬਣਾਉਣੀ ਸ਼ੁਰੂ ਕੀਤੀ ਉਹਨਾਂ ਦੇ ਅਨੁਸਾਰ ਇਹ ਪੰਜਾਬ ਸਨ ਸੰਕਟ ਦੇ ਦੌਰਾਨ ਫੈਲੀ ਹਿੰਸਾ ਅਤੇ ਆਤੰਕ ਦੇ ਖਤਮ ਹੋਣ ਉਪਰੰਤ ਪੱਛਮੀ ਦੇਸ਼ਾਂ ਦੀਆਂ ਵਿਕਸਿਤ ਸਰਮਾਏਦਾਰੀ ਸਰਕਾਰਾਂ ਅਤੇ ਅਰਥਚਾਰਿਆਂ ਉੱਤੇ ਕਾਬਜ ਮਾਂਤਰੀ ਕੰਪਨੀਆਂ ਅਤੇ ਉਨ੍ਹਾਂ ਦੇ ਸਰਬ ਵਿਆਪਕ ਸਰਬ ਵਿਆਪਕ ਅਤੇ ਸਰਬ ਗਿਆਨੀ ਦਰਸਾਉਣ ਵਾਲੇ ਸੰਚਾਰ ਮਾਧਿਅਮਾ ਤੋਂ ਵਿਉਂਤ ਕਾਰਾਂ ਦੇ ਬੋਲ ਬਾਲੇ ਅਤੇ ਉਹਨਾਂ ਨਾਲ ਹੀ ਸੁਰ ਮਿਲਾ ਕੇ ਚੱਲਣ ਵਾਲੀਆਂ ਤੀਜੀ ਦੁਨੀਆ ਦੀਆਂ ਹਾਕਮ ਜਮਾਤਾਂ ਦੇ ਮੁਕੰਮਲ ਸਮਰਪਣ ਹੋਇਆ ਹੈ ਹਰਵਿੰਦਰ ਭੰਬਾਲ ਨੇ ਕੰਮ ਅਤੇ ਦੇਹ ਤੋਂ ਸਰੋਕਾਰ ਨਾਲ ਸੰਬੰਧਿਤ ਕਵਿਤਾ ਨੂੰ ਸਮਕਾਲੀ ਕਵਿਤਾ ਨੂੰ ਬਣਾਇਆ ਇਸ ਨੂੰ ਮਾਨਵ ਇਤਿਹਾਸ ਦੀ ਪ੍ਰਤੀਕਿਰਿਆ ਵੱਜੋਂ ਪੇਸ਼ ਕੀਤਾ ਹੈ